ਪ੍ਰਿੰਟ ਮੀਡੀਆ ਜਿਵੇਂ ਕਿ ਅਖਬਾਰ ਅਤੇ ਮੈਗਜ਼ੀਨ ਜੋ ਕਿ ਅਗਲੇ ਦਿਨ ਆਉਂਦੇ ਹਨ ਇਸ ਵਿੱਚ ਹਮੇਸ਼ਾਂ ਇੱਕ ਦਿਨ ਪੁਰਾਣੀ ਖਬਰ ਮਿਲਦੀ ਹੈ ਜਦ ਕਿ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਵਿੱਚ ਸਾਨੂੰ ਉਸੇ ਵਕਤ ਹੀ ਖਬਰ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਪਰ ਇਹ ਨਹੀਂ ਕਿ ਅਖਬਾਰਾਂ ਦੀ ਕੋਈ ਅਹਿਮੀਅਤ ਨਹੀਂ ਮੈਂ ਹਰ ਰੋਜ਼ ਅਖਬਾਰ ਪੜ੍ਹਦੀ ਹਾਂ ਅਤੇ ਨਿਊਜ਼ ਚੈਨਲ ਵੀ ਦੇਖਦੀ ਹਾਂ ਇਹਨਾਂ ਦੋਨਾਂ ਦੀ ਆਪਸ ਵਿੱਚ ਆਪਣੀ ਜਗ੍ਹਾ ਮਹੱਤਤਾ ਹੈ ਬਸ ਅੰਤਰ ਇੰਨਾਂ ਹੈ ਕਿ ਅਖਬਾਰ ਵਿੱਚ ਸਾਨੂੰ ਬਾਅਦ ਵਿੱਚ ਖਬਰ ਮਿਲਦੀ ਹੈ ਜਦ ਕਿ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲ ਤੋਂ ਸਾਨੂੰ ਉਸ ਦਿਨ ਹੀ ਖਬਰ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਮੈਂ ਹੋਰ ਵੀ ਕਈ ਚੀਜ਼ਾਂ 'ਤੇ ਭਰੋਸਾ ਕਰਦੀ ਹਾਂ ਸਾਨੂੰ ਆਸ ਪਾਸ ਦੇ ਲੋਕਾਂ ਤੋਂ ਵੀ ਬਹੁਤ ਜਾਣਕਾਰੀ ਮਿਲਦੀ ਹੈ ਪਰ ਸਾਨੂੰ ਹਰ ਇੱਕ ਖਬਰ 'ਤੇ ਸੋਚ ਸਮਝ ਕੇ ਭਰੋਸਾ ਕਰਨਾ ਚਾਹੀਦਾ ਹੈ ਚਾਹੇ ਉਹ ਖਬਰ ਸਾਨੂੰ ਕਿਸੇ ਚੀਜ਼ ਤੋਂ ਵੀ ਮਿਲੇ ਮੈਗਜ਼ੀਨਾਂ ਤੋਂ ਵੀ ਸਾਨੂੰ ਖਬਰਾਂ ਤੋਂ ਇਲਾਵਾ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਹਨ ਇਸ ਵਿੱਚ ਸਾਨੂੰ ਤਰ੍ਹਾਂ ਤਰ੍ਹਾਂ ਦੇ ਫੈਸ਼ਨ ਅਪਡੇਟਸ ਅਤੇ ਕਹਾਣੀਆਂ ਵ ਕਹਾਣੀਆਂ ਵੀ ਮਿਲਦੀਆਂ ਹਨ ਇਸ ਤੋਂ ਇਲਾਵਾ ਨਿਊਜ ਚੈਨਲ 'ਤੇ ਬਹੁਤ ਸਾਰੇ ਐਡਵਰਟਾਈਜਮੈਂਟਾਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਵੀ ਪਤਾ ਚੱਲਦਾ ਹੈ ਸੋਸ਼ਲ ਮੀਡੀਆ 'ਤੇ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਪਤਾ ਲੱਗਦਾ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਅਸੀਂ ਆਪਸ 'ਚ ਗੱਲਾਂ ਬਾਤਾਂ ਵੀ ਕਰ ਸਕਦੇ ਹਾਂ